ਸਤਿ ਸ਼੍ਰੀ ਅਕਾਲ ਅੱਜ ਮੈਂ ਸਵੇਰੇ ਬਰਗਰ ਹਟ 'ਤੇ ਔਡਰ ਦਿੱਤਾ ਸੀ ਅਤੇ ਔਡਰ ਦੇ ਵਿੱਚ ਮੇਰੇ ਚਾਰ ਬਰਗਰ ਸੀਗੇ ਅਤੇ ਔਡਰ ਨੰਬਰ ਦੋ ਤਿੰਨ ਅੱਠ ਨੌਂ ਚਾਰ ਚਾਰ ਜ਼ੀਰੋ ਜ਼ੀਰੋ ਅੱਠ ਸੀ ਅਤੇ ਮੈਂ ਇਹ ਔਡਰ ਕੈਂਸਲ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਕਿਸੇ ਕਾਰਨ ਘਰੋਂ ਬਾਹਰ ਜਾਣਾ ਪੈ ਰਿਹਾ ਅਤੇ ਇਹ ਔਡਰ ਨੂੰ ਰਿਸੀਵ ਕਰਨ ਵਾਲਾ ਵੀ ਕੋਈ ਨਹੀਂ ਹੈ ਇਸ ਕਰਕੇ ਉਹ ਔਡਰ ਨੂੰ ਕੈਂਸਲ ਕਰ ਦਿਓ ਕਿਉਂਕਿ ਇਸ ਔਡਰ ਨੂੰ ਰਿਸੀਵ ਕਰਨ ਵਾਲਾ ਘਰ ਕੋਈ ਨਹੀਂ ਹੈ ਅਤੇ ਬਾ ਕਿ ਜਿੰਨੇ ਵੀ ਚਾਰਜਸ ਹੋ ਸਕਦੇ ਇਸ ਔਡਰ ਦੇ ਉਹ ਤੁਸੀਂ ਕੱਟ ਸਕਦੇ ਹੋ ਅਤੇ ਬਾਕੀ ਜੋ ਵੀ ਬਚੇ ਹੋਣਗੇ ਉਹ ਤੁਸੀਂ ਮੈਨੂੰ ਵੀ ਰਿਫੰਡ ਕਰ ਸਕਦੇ ਹੋ ਜਿੰਨੀ ਜਲਦੀ ਹੋ ਸਕਦਾ ਤੁਸੀਂ ਇਹਨੂੰ ਰਿਫੰਡ ਕਰ ਦਿਓ ਧੰਨਵਾਦ